ਮੈਨੂੰ ਮੇਰੇ ਬੱਚਿਆਂ ਲਈ ਕਲਰ ਪੈਨਸਿਲ ਦੀ ਜ਼ਰੂਰਤ ਸੀ ਅਤੇ ਮੈਂ ਇਸ ਨੂੰ ਲੈਣ ਲਈ ਬਜ਼ਾਰ ਚਲੀ ਗਈ ਜਦ ਮੈਂ ਬਜ਼ਾਰ ਗਈ ਤਾਂ ਮੈਂ ਉੱਥੇ ਵੇਖਿਆ ਕਿ ਉੱਥੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਕਲਰ ਪੈਨਸਿਲਾਂ ਸਨ ਪਰ ਉਸ ਦੇ ਰੇਟ ਬਹੁਤ ਹੀ ਮਹਿੰਗੇ ਸਨ ਜਿਸ ਕਰਕੇ ਮੈਂ ਉਨਾਂ ਨੂੰ ਨਹੀਂ ਖਰੀਦਿਆ ਅਤੇ ਮੈਂ ਘਰ ਆ ਗਈ ਮੈਂ ਸੋਚਿਆ ਕਿਉਂ ਨਾ ਮੈਂ ਇਹਨਾਂ ਕਲਰ ਪੈਨਸਿਲਾਂ ਨੂੰ ਔਨਲਾਈਨ ਔਡਰ ਕਰ ਦੇਵਾਂ ਅਤੇ ਮੈਂ ਜਦੋਂ ਔਨਲਾਈਨ ਉਸ ਨੂੰ ਔਡਰ ਕੀਤਾ ਅਤੇ ਉਸਦੇ ਮਾਰਕੀਟ ਨਾਲੋਂ ਉਸਦੇ ਰੇਟ ਵੀ ਬਹੁਤ ਘੱਟ ਸਨ ਅਤੇ ਉਹ ਬਹੁਤ ਹੀ ਸ ਸੋਹਣੀਆਂ ਸਨ ਅਤੇ ਬਹੁਤ ਹੀ ਸਸਤੀਆਂ ਵੀ ਸਨ ਜਦੋਂ ਮੈਂ ਉਹਨਾਂ ਨੂੰ ਮੰਗਵਾਇਆ ਤਾਂ ਬਹੁਤ ਹੀ ਵਧੀਆ ਉਹ ਵੋਹ ਪੈਨਸਿਲਾਂ ਜਿਵੇਂ ਕਿ ਔਨਲਾਈਨ ਵਿਖਾਇਆ ਗਿਆ ਸੀ ਉਵੇਂ ਹੀ ਉਹ ਕਲਰ ਪੈਨਸਿਲਾਂ ਸਨ ਉਹ ਕੰਮ ਉਹਨਾਂ ਦਾ ਵਰਕ ਵੀ ਬਹੁਤ ਸੋਹਣਾ ਸੀ ਪਹਿਲਾਂ ਮੈਂ ਸੋਚਦੀ ਸੀ ਕਿ ਔ ਔਨਲਾਈਨ ਜੋ ਚੀਜ਼ਾਂ ਹਨ ਉਹ ਸਹੀ ਨਹੀਂ ਹਨ ਪਰ ਜਦੋਂ ਮੈਂ ਕਲਰ ਪੈਨਸਿਲ ਮੰਗਵਾਈਆਂ ਤਾਂ ਉਹ ਬਹੁਤ ਹੀ ਵਧੀਆ ਨਿਕਲੀਆਂ ਔਰ ਇਹਨਾਂ ਦੇ ਰੇਟ ਵੀ ਬਹੁਤ ਘੱਟ ਹਨ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਉਹਨਾਂ ਨੂੰ ਔਨਲਾਈਨ ਔਡਰ ਕੀਤਾ ਔਰ ਜੋ ਕਿ ਉਹ ਕੰਮ ਬੱਚਿਆਂ ਦੇ ਕੰਮ ਕਰਨ ਵਿੱਚ ਵੀ ਬਹੁਤ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਸਨ ਬਹੁਤ ਹੀ ਬਹੁਤ ਹੀ ਸੋਹਣੀਆਂ ਸਨ ਅਤੇ ਮੈਨੂੰ ਉਹ ਬਹੁਤ ਹੀ ਵਧੀਆ ਲੱਗੀਆਂ ਇਸ ਕਰਕੇ ਮੈਨੂੰ ਔਨਲਾਈਨ ਜੋ ਮੈਂ ਔਡਰ ਕੀਤਾ ਮੈਨੂੰ ਜੋ ਦਿਖਾਇਆ ਗਿਆ ਮੈਨੂੰ ਉਹੀ ਮਿਲਿਆ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ